ਮੈਂ ਆਪਣੇ ਜੀਵਨ ਵਿੱਚ ਕਈ ਲਾਈਵ ਮਾਡਲ ਜਾਂ ਸਥਿਰ ਜੀਵਨ ਸੈਟਅਪ ਤੋਂ ਦੇਖ ਕੇ ਕਈ ਚਿੱਤਰ ਬਣਾਏ ਹਨ ਕਈ ਤਸਵੀਰਾਂ ਵੀ ਬਣਾਈਆਂ ਹਨ ਉਹਨਾਂ ਵਿੱਚ ਇੱਕ ਤਸਵੀਰ ਮੈਂ ਝੀਲ ਦੇ ਕਿਨਾਰੇ 'ਤੇ ਬਹਿ ਕੇ ਬਣਾਈ ਹੈ ਪਰ ਮੇਰਾ ਅਨੁਭਵ ਉਹਦੇ ਵਿੱਚ ਬਹੁਤ ਵਧੀਆ ਗਿਆ ਹੈ ਪਰ ਮੈਨੂੰ ਮੁਸ਼ਕਲਾਂ ਦਾ ਥੋੜ੍ਹਾ ਜਿਹਾ ਸਾਹਮਣਾ ਕਰਨਾ ਜ਼ਰੂਰ ਪਿਆ ਕਿਉਂਕਿ ਜਦੋਂ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਤੁਸੀਂ ਚਿੱਤਰ ਬਣਾ ਰਹੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਕਰ ਰਹੇ ਹੋ ਤੁਹਾਨੂੰ ਥੋੜ੍ਹੀਆਂ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਪੈਂਦਾ ਹੈ ਜਿਵੇਂ ਕਿ ਵਾਤਾਵਰਨ ਦਾ ਥੋੜ੍ਹਾ ਜਿਹਾ ਬਦਲਣਾ ਖਰਾਬ ਹੋ ਜਾਣਾ ਤੇਜ਼ ਹਵਾ ਦਾ ਚੱਲਣਾ ਨਾ ਚੱਲਣਾ ਪੰਛੀਆਂ ਦਾ ਆਉਣਾ ਜਾਣਾ ਆਵਾਜ਼ਾਂ ਚਿੱਤਰ ਬੇਸ਼ੱਕ ਦੀ ਬਹੁਤ ਵਧੀਆ ਬਣਿਆ ਹੈ ਜੋ ਤਸਵੀਰ ਬਣਾਈ ਹੈ ਬਹੁਤ ਵਧੀਆ ਬਣੀ ਹੈ ਪਰ ਥੋੜ੍ਹੀਆਂ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਗਿਆ ਉਸ ਤੋਂ ਬਾਅਦ ਇੱਕ ਕਹਿ ਲਈਏ ਆਪਾਂ ਬਾਜ਼ਾਰ ਦੇ ਵਿੱਚ ਕਈ ਵਾਰ ਕੋਈ ਚਿੱਤਰ ਬਣਾਉਣਾ ਹੋਵੇ ਜਾਂ ਕੋਈ ਐਸਾ ਕੋਈ ਵਧੀਆ ਬੁੱਤ ਲੱਗਿਆ ਹੋਵੇ ਉਸ ਨੂੰ ਦੇਖ ਕੇ ਕੋਈ ਲਾਈਵ ਮਾਡਲ ਚਿੱਤਰ ਬਣਾਉਣਾ ਹੋਵੇ ਉਸ ਵਿੱਚ ਆਲੇ ਦੁਆਲੇ ਦਾ ਸ਼ੋਰ ਸ਼ਰਾਬਾ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਥੋੜ੍ਹੀ ਮੁਸ਼ਕਲ ਹੋ ਜਾਂਦੀ ਹੈ ਪਰ ਮੇਰਾ ਅਨੁਭਵ ਇਹਨਾਂ ਵਿੱਚ ਬਹੁਤ ਜ਼ਿਆਦਾ ਵਧੀਆ ਗਿਆ ਹੈ